ਅੱਜ ਕੱਲ੍ਹ ਭਾਰਤ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਪ੍ਰਦੂਸ਼ਣ ਦੀ ਐਨੀ ਬਹੁਤ ਜ਼ਿਆਦਾ ਫੈਕਟਰੀਆਂ ਦੇ ਧੂੰਏ ਨਾਲ ਔਰ ਬਹੁਤ ਜ਼ਿਆਦਾ ਵੱਧ ਗਿਆ ਹੈ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਹਨ ਅਤੇ ਅ ਕਾਰਾਂ ਕੂਰਾਂ ਗੱਡੀਆਂ ਦਾ ਐਨਾ ਰ ਉਹ ਹੋ ਗਿਆ ਜੀ ਬਹੁਤ ਜ਼ਿਆਦਾ ਪ੍ਰਦੂਸ਼ਣ ਅਤੇ ਆਲੇ ਦੁਆਲੇ ਦੇ ਬਹੁਤ ਨਦੀਆਂ ਦ ਨਾਲੇ ਬਹੁਤ ਦ ਸੁੱਕੇ ਹੋਏ ਉਹਨਾਂ ਦੇ ਵਿੱਚ ਫੈਕਟਰੀਆਂ ਦਾ ਗੰਦਾ ਪਾਣੀ ਛੱਡਿਆ ਜਾਂਦਾ ਹੈ ਮਿੱਟੀ ਨਦੀਆਂ ਜੰਗਲਾਂ ਔਰ ਅਤੇ ਮੌਸਮ ਬਹੁਤ ਵਿਗੜ ਚੁੱਕੇ ਹਨ ਸਾਉਣ ਦੇ ਮਹੀਨੇ ਵਿੱਚ ਅੱਗੇ ਬਾਰਿਸ਼ਾਂ ਵੀ ਹੁੰਦੀਆਂ ਸੀਗੀਆਂ ਹੁਣ ਬਹੁਤ ਘੱਟ ਬਾਰਿਸ਼ ਹੋਣ ਲੱਗ ਗਈ ਬਦਲਾਅ ਹੋ ਗਏ ਬਹੁਤ ਧਰਤੀ ਬਦਲਾਤੀ ਜੰਗਲ ਬਹੁਤ ਆ ਸਾਡੇ ਇਲਾਕੇ ਦੇ ਵਿੱਚ ਜੰਗਲਾਂ ਦੇ ਵਿੱਚ ਬਹੁਤ ਕੁਛ ਕੱਟ ਵੱਢ ਕਰਕੇ ਸੁੱਟਿਆ ਹੋਇਆ ਹੈਗਾ ਬਹੁਤ ਤੰਗੀਆਂ ਕੱਟ ਰਹੇ ਨੇ ਲੋਕ ਐਨਾ ਪ੍ਰਦੂਸ਼ਣ ਤਾਂ ਬਹੁਤ ਹੀ ਜ਼ਿਆਦਾ ਹੈ ਜਿਹਦੇ ਕਾਰਨ ਤੇ ਕਾਫੀ ਪ੍ਰੋ ਬਿਮਾਰੀਆਂ ਖੜ੍ਹੀਆਂ ਹੁੰਦੀਆਂ ਹਨ ਇੰਨੇ ਉਹ ਛੱਪੜ ਦਾ ਗੰਦੇ ਪੜੇ ਪਏ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਮੱਛਰ ਵਗੈਰਾ ਬਹੁਤ ਕਾਫੀ ਨੁਕਸਾਨ ਕਰ ਰਿਹਾ ਹੈਗਾ ਬੰਦਿਆਂ ਦਾ ਜੀ ਅਤੇ ਮੌਸਮਾਂ ਵਿੱਚ ਐਨਾ ਬਦਲਾਅ ਹੋ ਗਿਆ ਕਿ ਧੁੱਪ ਗਰਮੀ ਨਾਲ ਬੁਰਾ ਹਾਲ ਲੋਕਾਂ ਦਾ ਕੀਤਾ ਹੋਇਆ ਹੈਗਾ ਬਹੁਤ ਲੋਕ ਤੰਗ ਹਨ ਤਾਂ ਕੀ ਕਰਨ ਬੇਚਾਰੇ ਹੁਣ ਬਾਰਿਸ਼ ਵੀ ਪੈਂਦੀ ਹੈ ਨਹੀਂ ਅਤੇ ਬਹੁਤ ਕੰਮ ਵਿਗੜਿਆ ਹੋਇਆ ਹੈਗਾ ਜੀ ਬਹੁਤ ਕਾਫੀ ਦਿੱਕਤਾਂ ਆਉਂਦੀਆਂ ਹਨ ਅਤੇ